ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਇਹ ਦੇਖੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੋਣਾ ਕੀ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅੱਠ ਫੇਸ ਮੋਹਾਲੀ ਤੋਂ ਹੀ ਹੁੰਦਾ ਹੈ ਅਤੇ ਆਪਣੀ ਓ ਆਪਾਂ ਅੱਠ ਫੇਸ ਜਾਂਦੇ ਆ ਮੋਹਾਲੀ ਉੱਥੇ ਇੱਕ ਬੱਸ ਲੈਂਦੇ ਆਂ ਅੱਠ ਫੇਸ ਦੀ ਹੈ ਨਾ ਉੱਥੇ ਅੱਠ ਫੇਸ ਦੀ ਬੱਸ ਲੈ ਕੇ ਉੱਥੇ ਤੁਸੀਂ ਕਿਸੀ ਵੀ ਆਟੋ ਵਾਲੇ ਨੂੰ ਜਾਂ ਕਿਸੀ ਵੀ ਜੇ ਤੁਸੀਂ ਆਪਣੇ ਪ੍ਰਾਈਵੇਟ ਵਹੀਕਲ 'ਤੇ ਜਾ ਰਹੇ ਹੋ ਤਾਂ ਅੱਠ ਫੇਸ ਨੀਅਰ ਫੋਰਟਿਸ ਹੋਸਪਿਟਲ ਕੋਲ ਤੁਸੀਂ ਕਹਿ ਸਕਦੇ ਹੋ ਠੀਕ ਹੈ ਬਸ ਉੱਥੇ ਹੀ ਤੁਸੀਂ ਕਿਸੀ ਨੂੰ ਵੀ ਪੁੱਛ ਲਓ ਬਿਲਕੁਲ ਸਾਹਮਣੇ ਬਿਲਡਿੰਗ ਹੈ ਉੱਥੇ ਤੁਸੀਂ ਪਹੁੰਚੋਂਗੇ ਠੀਕ ਹੈ ਆਪਾਂ ਉੱਥੇ ਹੈਗਾ ਸੈਕਿੰਡ ਫਲੋਰ ਵੀ ਹੈਗਾ ਜੇ ਸੈਕਿੰਡ ਫਲੋਰ 'ਤੇ ਜਾ ਕੇ ਉੱਥੇ ਪੁੱਛ ਗਿੱਛ ਸੈਂਟਰ ਵੀ ਹੈਗਾ ਉੱਥੇ ਦੱਸ ਦੇਣਗੇ ਉਹ ਕੋਈ ਦਿੱਕਤ ਨਹੀ ਹੈ ਜੇ ਜਾਣਾ ਆਪਾਂ ਮਿਲ ਕੇ ਚੱਲਾਂਗੇ ਜੇ ਤੁਹਾਨੂੰ ਇਸ਼ੂ ਹੈ ਤਾਂ ਔਰ ਟਾਈਮ ਐਂਡ ਕਿ ਦੇਖੋ ਦਫ਼ਤਰੀ ਕੰਮਾਂ ਵਿੱਚ ਟਾਈਮ ਤਾਂ ਲੱਗ ਹੀ ਜਾਂਦਾ ਹੈ ਹਫ਼ਤਾ ਵੀ ਲੱਗ ਜਾਂਦਾ ਪੰਦਰਾਂ ਦਿਨ ਵੀ ਲੱਗ ਜਾਂਦੇ ਨੇ ਪਰ ਐਕਸ਼ਨ ਹੈ ਮੈਨੂੰ ਲੱਗਦਾ ਪਹਿਲਾਂ ਤਾਂ ਉਹ ਜਮਾਂ ਕਰਦੇ ਨੇ ਸਰਟੀਫਿਕੇਟ ਉਹ ਸੋਰੀ ਇੱਕ ਹੁੰਦਾ ਨਾ ਫੋਰਮ ਹੁੰਦਾ ਹੈ ਫੋਰਮ ਜਮਾਂ ਕਰਵਾਣਗੇ ਉਸ ਤੋਂ ਬਾਅਦ ਮੇਰੇ ਖ਼ਿਆਲ 'ਚ ਜਿਹੜਾ ਇਹ ਪੰਦਰਾਂ ਕੁ ਦਿਨ ਦਾ ਪ੍ਰੋਸੈਸ ਹੈ ਹੀ ਹੈ ਹੈ ਨਾ ਮੈਨੂੰ ਵੀ ਮੈ ਵੀ ਜਾਣਾ ਸੀ ਕਿਉਂਕਿ ਮੇਰਾ ਵੀ ਇੱਕ ਹੈਗਾ ਸਰਟੀਫਿਕੇਟ ਦਾ ਮਾਮਲਾ ਚਲ ਰਿਹਾ ਅਤੇ ਫਿਰ ਮੈਨੇ ਵੀ ਜਾਣਾ ਫਿਰ ਆਪਾਂ ਇਕੱਠੇ ਹੀ ਚੱਲਦੇ ਹਾਂ ਤੁਸੀਂ ਕਿਸ ਦਿਨ ਜਾਣਾ ਅੱਛਾ ਅੱਛਾ ਠੀਕ ਹੈ ਤੁਸੀਂ ਆਪਣੀ ਤੁਸੀਂ ਆਪ ਤਤਕਾਲ 'ਚ ਤਾਂ ਮੈਨੂੰ ਲਗਦਾ ਉਹ ਫ਼ੀਸ ਜਮਾਂ ਕਰਾਉਂਦੇ ਹੈ ਅੱਠ ਸੌ ਰੁਪਏ ਜਾਂ ਇਹਨੇ ਫ਼ੀਸ ਦੇ ਅਨੁਸਾਰ ਹੈਗਾ ਅਤੇ ਉਸ ਤੋਂ ਬਾਅਦ ਹੀ ਹੈ ਇਹ ਸਭ ਹੁੰਦਾ ਚਲੋ ਠੀਕ ਹੈ ਜੀ ਓਕੇ ਓਕੇ